ਮੇਰੀ ਇੱਕ ਸਹੇਲੀ ਸੀ ਜਿਸ ਦਾ ਵਜ਼ਨ ਬਹੁਤ ਜ਼ਿਆਦਾ ਸੀ ਉਸ ਨੇ ਬਹੁਤ ਤਰੀਕੇ ਖਾਣ ਪੀਣ ਦੇ ਅਪਣਾਏ ਪਰ ਉਸ ਨੂੰ ਕੋਈ ਫ਼ਰਕ ਨਾ ਪਿਆ ਇਸ ਕਰਕੇ ਮੈਂ ਉਸਨੂੰ ਭਾਰਤ ਭੰਗੜਾ ਅਰੇਬਿਸਤ ਦੀ ਸਲਾਹ ਦਿੱਤੀ ਉਸ ਨੇ ਇਹ ਭੰਗੜਾ ਅਰੇਬਿਤਸ ਸਿੱਖਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਸ ਦਾ ਹੌਲੀ ਹੌਲੀ ਵਜ਼ਨ ਵੀ ਘਟਨਾ ਸ਼ੁਰੂ ਹੋ ਗਿਆ ਅਤੇ ਉਸ ਨੇ ਅਰੇਬਿਤਸ ਭੰਗੜਾ ਅਰੇਬਿਤਸ ਵੀ ਸਿੱਖ ਲਿਆ ਅਤੇ ਉਸਨੇ ਨਵਾਂ ਇੱਕ ਲੋਕ ਨਾਚ ਵੀ ਸਿੱਖਣ ਦੇ ਨਾਲ ਨਾਲ ਉਸਦੀ ਸਿਹਤ ਵੀ ਬਹੁਤ ਵਧੀਆ ਹੋ ਗਈ